ਸਤਿ ਸ਼੍ਰੀ ਅਕਾਲ ਜੀ ਮੈਂ ਬਰਿੰਦਰ ਸਿੰਘ ਬੋਲ ਰਿਹਾ ਯਾਰ ਜਿਹੜਾ ਤੁਸੀਂ ਮੈਨੂੰ ਪੱਖਾ ਭੇਜਿਆ ਉਹ ਤਾਂ ਬੜਾ ਬੇਕਾਰ ਨਿਕਲਿਆ ਉਹਦੇ ਵਿੱਚ ਤਾਂ ਕੋਈ ਫਿਊਚਰ ਨਹੀਂ ਚੱਜ ਦਾ ਹੈਗਾ ਉਹ ਘੱਟ ਵੱਧ ਕਰਨੇ ਵਾਲਾ ਵੀ ਯਾਰ ਮਹੀਨੇ ਕੁ ਬਾਅਦ ਸੜ ਗਿਆ ਉਹਦਾ ਜਮ੍ਹਾ ਹੀ ਬੇਕਾਰ ਪੱਖਾ ਨਿਕਲਿਆ ਉਸ ਤੋਂ ਵਿੱਚੋਂ ਸਮੈਲ ਵੀ ਕੁਛ ਇਹ ਜਿਹੀ ਮਾਰ ਰਹੀ ਹੈ ਬੇਕਾਰ ਜਮ੍ਹਾ ਯਾਰ ਪੱਖਾ ਬੇਕਾਰ ਹੈ ਤੁਹਾਡਾ ਮੈਂ ਤਾਂ ਬਹੁਤ ਦੁਖੀ ਹੋ ਗਿਆ ਮੈਨੂੰ ਮੇਰੇ ਯਾਰ ਦੋਸਤ ਮਖੌਲ ਕਰਦੇ ਕਹਿੰਦੇ ਕਿਹੜੀ ਔਨਲਾਈਨ ਤੋਂ ਤੂੰ ਪੱਖਾ ਮੰਗਵਾ ਲਿਆ ਉਹ ਕਹਿੰਦੇ ਵੀ ਸਾਨੂੰ ਦੱਸ ਦੇ ਇੱਥੋਂ ਬਾਜ਼ਾਰ ਵਿੱਚ ਵਧੀਆ ਪੱਖੇ ਮਿਲਦੇ ਹੈ ਇੱਕ ਤੋਂ ਇੱਕ ਕੰਪਨੀ ਦੇ ਪੱਖਾ ਪਿਆ ਮੈਂ ਯਾਰ ਤੁਹਾਡੇ ਪਰ ਵਿਸ਼ਵਾਸ ਕਰਦਾ ਸੀ ਪਰ ਇਸ ਨੇ ਮੇਰਾ ਵਿਸ਼ਵਾਸ ਤੋੜਤਾ ਯਾਰ